ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਦੋ ਅਕਤੂਬਰ ਉੱਨੀ ਸੌ ਇਕਾਸੀ ਫਸਟ ਜਨਵਰੀ ਉਨੀ ਸੌ ਤ੍ਰਿਆਸੀ ਇਕੱਤੀ ਦਸੰਬਰ ਵੀਹ ਸੌ ਦਸ